ਕਸਰਤ ਕਰਨ ਤੋਂ ਪਹਿਲਾਂ ਗਰਾਊਂਡ ਵਿੱਚ ਜਾ ਕੇ ਮੈਂ ਰਨਿੰਗ ਕਰਦਾ ਹਾਂ ਰਨਿੰਗ ਕਰਨ ਦੇ ਨਾਲ਼ ਮੇਰੇ ਸਰੀਰ ਦੀਆਂ ਮਾਸਪੇਸ਼ੀਆਂ ਸਤਰਕ ਹੋ ਜਾਂਦੀਆਂ ਨੇ ਜਿਸ ਨਾਲ਼ ਮੈਂ ਸਾਰਾ ਦਿਨ ਤੰਦਰੁਸਤ ਰਹਿੰਦਾ ਹਾਂ